ਸਮੇਂ ਦੇ ਨਾਲ ਫੋਟੋਗ੍ਰਾਫਰ ਦੀ ਭੂਮਿਕਾ ਬਦਲ ਗਈ ਹੈ ਪਹਿਲਾਂ ਲੋਕ ਫੋਟੋਆਂ ਫੋਟੋਗ੍ਰਾਫਰ ਕੋਲ ਜਾ ਕੇ ਖਿਚਵਾਉਂਦੇ ਸੀ ਪਰ ਅੱਜ ਕੱਲ੍ਹ ਫੋਨ ਦੇ ਆਉਣ ਨਾਲ ਲੋਕ ਆਪ ਹੀ ਸੈਲਫੀਆਂ ਖਿੱਚਣ ਲੱਗ ਪਏ ਹਨ ਕੋਈ ਫੋਟੋਗ੍ਰਾਫਰ ਨੂੰ ਇੰਨਾ ਨਹੀਂ ਬੁਲਾਉਂਦਾ ਨਾ ਹੀ ਉਹਦੇ ਕੋਲ ਉੰਨੀਆਂ ਫੋਟੋਆਂ ਹੁੰਦੀਆਂ ਹਨ ਪਹਿਲਾਂ ਫੋਟੋਗ੍ਰਾਫਰ ਦੀ ਕਮਾਈ ਬਹੁਤ ਜ਼ਿਆਦਾ ਹੁੰਦੀ ਸੀ ਪਰ ਹੁਣ ਅੱਜ ਦੇ ਸਮੇਂ ਵਿੱਚ ਫੋਟੋਗ੍ਰਾਫਰ ਇੰਨਾਂ ਨਹੀਂ ਕਮਾ ਪਾਂਦਾ ਫੋਟੋਗ੍ਰਾਫ ਨੂੰ ਅੱਜ ਕੱਲ੍ਹ ਲੋਕ ਜਦੋਂ ਵਿਆਹ ਕਰਾਉਣੇ ਹੁੰਦੇ ਹਨ ਉਦੋਂ ਹੀ ਸੱਦਦੇ ਹਨ ਜਾਂ ਘਰ ਵਿੱਚ ਕੋਈ ਫੰਕਸ਼ਨ ਹੋਣਾ ਹੁੰਦਾ ਹੈ ਉਦੋਂ ਸੱਦਦੇ ਹਨ ਫੋਟੋਗ੍ਰਾਫਰ ਨੂੰ ਛੋਟੀਆਂ ਮੋਟੀਆਂ ਚੀਜ਼ਾਂ ਲਈ ਅੱਜ ਕੱਲ੍ਹ ਲੋਕ ਫੋਟੋਆਂ ਨਹੀਂ ਖਿਚਵਾਉਂਦੇ ਕਿਉਂਕਿ ਉਹਦੇ ਏ ਲਈ ਅੱਜ ਕੱਲ੍ਹ ਫੋਨ ਆ ਗਏ ਹਨ ਅਤੇ ਫੋਟੋਗਰਾਫਰ ਜਿਹੜੇ ਹੁੰਦੇ ਹਨ ਅੱਜ ਕੱਲ੍ਹ ਪੱਚੀ ਤੋਂ ਤੀਹ ਹਜ਼ਾਰ ਰੁਪਈਆ ਜਾਂ ਫਿਰ ਤੁਸੀਂ ਪੰਜਾਹ ਹਜ਼ਾਰ ਤੱਕ ਵੀ ਲਗਾ ਲਓਗੇ ਅਤੇ ਇੱਥੋਂ ਤੱਕ ਕਮਾ ਲੈਂਦੇ ਹਨ ਪਰ ਮਤਲਬ ਉਹਨਾਂ ਦਾ ਰੋਜ਼ੀ ਰੋਟੀ ਉਦੋਂ ਚੱਲਦਾ ਵਾ ਜਦੋਂ ਵਿਆਹ ਦੇ ਸੀਜ਼ਨ ਆਉਂਦੇ ਹਨ ਕਿਉਂਕਿ ਜ਼ਿਆਦਾਤਰ ਇਹਨਾਂ ਨੂੰ ਵਿਆਹਾਂ 'ਤੇ ਬੁਲਾਇਆ ਜਾਂਦਾ ਵਾ